ਹਾਂਜੀ ਸਤਿ ਸ਼੍ਰੀ ਕਾਲ ਭਾਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਮੈਂ ਰੈਲ ਮਾਜਰੇ ਵਾਲ਼ਾ ਮਨੀ ਬੋਲ ਰਿਹਾਂ ਜੀ ਹੋਰ ਹਾਂਜੀ ਹਾਂਜੀ ਪਛਾਣ ਲਿਆ ਜੀ ਠੀਕ ਹੈ ਠੀਕ ਹੈ ਉਹ ਮੇਰੀ ਨਾ ਪਰਸੋਂ ਬਰਡੇ ਪਾਰਟੀ ਸੀਗੀ ਜੀ ਮੈਂ ਤੁਹਾਡੇ ਕੋਲ ਬੁਕਿੰਗ ਕਰਵਾ ਕੇ ਗਿਆ ਸੀਗਾ ਆਪਣੀ ਉਹ ਜਿਹੜਾ ਆਪਣਾ ਪਾਰਟੀ ਕਰਨੀ ਸੀਗੀ ਉਹਦੇ ਲਈ ਹੋਲ ਵੀ ਬੁੱਕ ਕਰਿਆ ਹੋਇਆ ਸੀਗਾ ਅਤੇ ਹੋਰ ਕੇਕ ਵਗੈਰਾ ਅਤੇ ਖਾਣ ਪੀਣ ਦਾ ਜਿਹੜਾ ਸਮਾਨ ਸੀਗਾ ਉਹ ਸਾਰਾ ਬੁੱਕ ਕਰਿਆ ਹੋਇਆ ਸੀਗਾ ਅਤੇ ਉਹ ਜਿੱਦਾਂ ਆਪਾਂ ਨੇ ਤਿੰਨ ਰੂਮ ਬੁੱਕ ਕਰੇ ਸੀਗੇ ਰਹਿਣ ਲਈ ਉਹ ਸਾਡੇ ਕ ਜਿਹੜੇ ਰਿਸ਼ਤੇਦਾਰ ਆ ਰਹੇ ਦੂਰ ਤੋਂ ਉਹਨਾਂ ਨੂੰ ਇੱਥੀ ਹੋਟਲ 'ਚ ਹੀ ਰਖਵਾਉਣਾ ਸੀਗਾ ਮੈਂ ਅਤੇ ਮੈਂ ਪਤਾ ਕਰਨਾ ਸੀਗਾ ਉਹਨਾਂ ਨਾਲ ਨਾ ਉਹਨਾਂ ਦਾ ਹੀ ਦੋ ਗੱਡੀਆਂ ਹੋਣਗੀਆਂ ਗੱਡੀ ਦੀ ਪਾਰਕਿੰਗ ਹੋਊਗੀ ਉੱਥੇ ਹਾਂ ਜੇ ਪਾਰਕਿੰਗ ਹੈਗੀ ਆ ਤਾਂ ਉਹਨਾਂ ਸੇਫਟੀ ਹੈਗੀ ਨਾ ਆਪਣੀ ਅੰਦਰ ਖੜਦੀ ਨਾ ਪਾਰਕਿੰਗ 'ਚ ਗੱਡੀ ਬਸ ਮੈਂ ਆਹੀ ਕਨਫਰਮ ਕਰਨਾ ਸੀਗਾ ਅਤੇ ਜਿੰਨਾ ਵੀ ਮੇਰਾ ਔਰਡਰ ਹੈ ਅਤੇ ਟਰਾਈ ਕਰਿਓ ਵੀ ਜ਼ਿਆਦਾ ਲੇਟ ਨਾ ਹੋਵੇ ਵੀ ਉੱਥੇ ਟਾਇਮ ਨਾ ਸਿਰ ਸਾਰੇ ਖਾ ਪੀ ਕੇ ਆਪਣਾ ਜਿਨਾਂ ਨੇ ਘਰੇ ਨਿਕਲਣਾ ਘਰੇ ਨਿਕਲ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ